ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਮੇਰੀ ਨਾ ਬੇਟੀ ਹੀ ਉਹਨਾਂ ਦਾ ਤਿੰਨ ਸਾਲ ਦੀ ਬੇਟੀ ਆ ਭਾਅ ਜੀ ਮੈਂ ਨਾ ਸਕੂਲ ਚੇਂਜ ਕਰਾਉਣਾ ਉਹਨਾਂ ਦਾ ਅਤੇ ਭਾਅ ਜੀ ਕਿਹੜਾ ਸਕੂਲ ਵਧੀਆ ਹੋਊਗਾ ਤੁਹਾਡੀ ਨਿਗਾਹ ਦੇ ਵਿੱਚ ਜਿੱਥੇ ਤੁਹਾਡੇ ਵੀ ਹਾਂਜੀ ਹਾਂਜੀ ਨਹੀਂ ਭਾਅ ਜੀ ਮੈਂ ਵਧੀਆ ਸਟਡੀ ਕਰਵਾਉਣਾ ਚਾਹੁੰਦਾ ਬੱਚੇ ਨੂੰ ਵੀ ਅਗਾਹਾਂ ਵੀ ਕੋਈ ਦਿੱਕਤ ਨਾ ਆਵੇਗੀ ਜਿੱਦਾਂ ਕਿ ਹੁਣ ਬਾਹਰ ਬੂਹਰ ਜਾਣਾ ਹੁੰਦਾ ਅਤੇ ਕਈਆਂ ਨੂੰ ਨਹੀਂ ਭਾਸ਼ਾ ਬੋਲਣੀ ਆਉਂਦੀ ਜਿੱਥੇ ਹਰ ਭਾਸ਼ਾ ਸਿਖਾਈ ਜਾਵੇ ਹਾਂਜੀ ਹਾਂਜੀ ਭਾਅ ਜੀ ਮੈਂ ਵੀ ਬੜਾ ਨਾਂ ਸੁਣਿਆ ਉੱਥੇ ਮੈਂ ਵੀ ਨਿੱਕੇ ਹੁੰਦਿਆਂ ਉੱਥੇ ਹੀ ਪੜ੍ਹ ਕੇ ਗਿਆ ਭਾਅ ਜੀ ਉਹ ਸਕੂਲ ਅੱਜ ਦਾ ਨਹੀਂ ਸਕੂਲ ਤਾਂ ਵਾਵਾ ਚਿਰ ਦਾ ਹੈ ਹਾਂਜੀ ਭਾਅ ਜੀ ਪੜ੍ਹਾਉਂਦੇ ਵੀ ਬੜਾ ਵਧੀਆ ਸਮਝਾਉਂਦੇ ਆ ਹਾਂਜੀ ਹਾਂਜੀ ਭਾਜੀ ਬਾਕੀ ਬਾਕੀ ਭਾਅ ਜੀ ਹੁਣ ਤਾਂ ਮੈਂ ਆਪਣੇ ਜਾ ਕੇ ਉਹਨਾ ਨਾਲ ਥੋੜ੍ਹੀ ਬਹੁਤੀ ਗੱਲਬਾਤ ਕਰਕੇ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਹਾਂਜੀ ਵਧੀਆ ਕਿੱਦਾਂ ਅਤੇ ਓਦਾਂ ਇੱਕ ਹੋਰ ਕੋਈ ਸਕੂਲ ਹੈਗਾ ਤੁਹਾਡੀ ਨਿਗਾਹ ਦੇ ਵਿੱਚ ਤਾਂ ਤੁਸੀਂ ਦੱਸ ਸਕਦੇ ਹੋ ਹਾਂਜੀ ਭਾਅ ਜੀ ਉਹਦੇ ਬਾਰੇ ਹਾਂਜੀ ਹਾਂਜੀ ਉਹ ਮੈਂ ਸੁਣਿਆ ਸੀ ਕਹਿੰਦੇ ਉਹ ਵਧੀਆ ਅਤੇ ਹਾਂਜੀ ਭਾਜੀ ਵਧੀਆ ਸਕੂਲਾਂ 'ਚ ਠੀਕ ਠੀਕ ਹੈ ਭਾਅ ਜੀ ਸਕੂਲ ਦੇ ਸਾਰੇ ਓਦਾਂ ਵਧੀਆ ਹੁੰਦੇ ਪਰ ਨਾ ਸਟਡੀ ਚਾਹੀਦੀ ਹੈ ਸਾਡੇ ਬੱਚੇ ਨੂੰ ਭਾਅ ਜੀ ਸਟਡੀ ਭਾਅ ਜੀ ਮੈਂ ਨਾ ਭਾਅ ਜੀ ਅਸੀਂ ਨਹੀਂ ਸਰਕਾਰੀ ਸਕੂਲ ਪੜ੍ਹਨ ਜੋਗੇ ਹੈਗੇ ਬੱਚੇ ਨੇ ਕਿੱਥੋਂ ਪੜ੍ਹ ਲੈਣਾ ਵਾ ਅਸੀਂ ਵੀ ਤੁਹਾਡੇ ਵਾਂਗ ਤੁਰੇ ਫਿਰਦੇ ਆ